ਪੀ ਟੀ ਊਸ਼ਾ ਕੇਰਲਾ ਦੀ ਜੰਮ ਪਲ ਸੀਗੀ ਅਤੇ ਉਹ ਜਿਹੜੀ ਆਪਣੀ ਇੰਡੀਅਨ ਐਸ਼ ਐਸੋਸੀਏਸ਼ਨ ਦੇ ਨਾਲ ਜੁੜੀ ਹੋਈ ਸੀਗੀ ਪੀ ਟੀ ਊਸ਼ਾ ਨੇ ਚਾਰ ਏਸ਼ੀਅਨ ਗੋਲਡ ਮੈਡਲ ਜਿੱਤੇ ਸੀ ਅਤੇ ਸੱਤ ਉਹਨੇ ਸਿਲਵਰ ਮੈਡਲ ਨੇ ਜਿਹੜੇ ਉਹ ਪ੍ਰਾਪਤ ਕੀਤੇ ਸੀ ਉਹਨੂੰ ਕੁਈਨ ਔਫ ਓ ਉਹਨੂੰ ਰਾਣੀ ਕਿਹਾ ਜਾਂਦਾ ਟਰੈਕ ਅਤੇ ਐਂਡ ਫੀਲਡ ਦੀ ਹੈ ਨਾ ਮਤਲਬ ਗਰਾਉਂਡ ਦੀ ਟਰੈਕ ਦੀ ਉਹ ਉੱਡਣ ਪਰੀ ਆ ਜਾਂ ਇੱਕ ਰਾਣੀ ਆ ਠੀਕ ਆ ਅਤੇ ਉਹਨਾਂ ਨੇ ਪੀ ਟੀ ਊਸ਼ਾ ਨੇ ਜਿਹੜੀ ਉਹਨੂੰ ਅੱਜ ਕੱਲ੍ਹ ਉਹਨੂੰ ਰਾਜ ਸਭਿਆ ਦਾ ਇੱਕ ਵੋਇਸ ਚੇਅਰਮੈਨ ਦਾ ਜਿਹੜਾ ਕੰਟਰੋਲ ਆ ਉਹ ਵੀ ਦਿੱਤਾ ਹੋਇਆ ਅਤੇ ਅਸੀਂ ਅਜਿਹੀ ਵੂਮੈਨ ਤੋਂ ਅਸੀਂ ਸ਼ਾਨਦਾਰ ਸਪੋਰਟਸ ਵੂਮੈਨ ਤੋਂ ਸਿੱਖਣਾ ਚਾਹਵਾਂਗੇ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਪੀ ਟੀ ਊਸ਼ਾ ਵਾਂਗੂੰ ਮਤਲਬ ਬਣਨਾ ਚਾਹੀਦਾ ਅਤੇ ਉਹਦੇ ਵਰਗੀ ਵਧੀਆ ਪਲੇਅਰ ਬਣਨਾ ਚਾਹੀਦਾ ਅਤੇ ਵਧੀਆ ਪਲੇਅਰ ਬਣ ਕੇ ਦੁਨੀਆਂ ਨੂੰ ਦਿਖਾਉਣਾ